ਜੇ ਸਾਨੂੰ ਮੌਕਾ ਦਿੱਤਾ ਜਾਵੇ ਤਾਂ ਅਸੀਂ ਭਾਰਤ ਦੀ ਭਾਰਤ ਵਿੱਚ ਮਿੱਟੀ ਦੇ ਬਰਤਨ ਉਹਨਾਂ ਉੱਪਰ ਚਿੱਤਰਕਾਰੀ ਜਾਂ ਉਹਨਾਂ ਨੂੰ ਪੇਂਟ ਕਰਨਾ ਉਹਨਾਂ ਉੱਪਰ ਸੋਹਣੀ ਮਹੀਵਾਲ ਦੇ ਪੇਂਟਿੰਗਸ ਲੈ ਕੇ ਕਲਾ ਸ਼ੈਲੀਆਂ ਨੂੰ ਦੂਜੇ ਦੇਸ਼ਾਂ ਵਿੱਚ ਵਿਖਾਉਣਾ ਚਾਹਵਾਂਗੇ ਬਹੁਤ ਸੋਹਣੇ ਸੋਹਣੇ ਸੋ ਮਿੱਟੀ ਦੇ ਬਰਤਨ ਬਣਾਏ ਜਾਂਦੇ ਹਨ ਜਿਹਨਾਂ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਅਲੱਗ ਅਲੱਗ ਡਿਜ਼ਾਈਨਾਂ ਨਾਲ ਉਹਨਾਂ ਨੂੰ ਪੇਂਟ ਕੀਤਾ ਜਾਂਦਾ ਹੈ ਚਿੱਤਰਕਾਰੀ ਕੀਤੀ ਜਾਂਦੀ ਹੈ ਅਤੇ ਜਿਹਨਾਂ ਨੂੰ ਬਹੁਤ ਸੋਹਣਾ ਬਣਾਇਆ ਜਾਂਦਾ ਹੈ ਕਿ ਪੂਰੇ ਆਲ ਇੰਡੀਆ ਵਿੱਚ ਉਹਨਾਂ ਨੂੰ ਵਿਖਾਇਆ ਜਾ ਸਕਦਾ ਹੈ ਅਤੇ ਲੋਕ ਪਸੰਦ ਕਰਦੇ ਨੇ ਦੂਸਰਾ ਹੱਥ ਦੇ ਕੰਮ ਜਿਵੇਂ ਸਲਾਈ ਕਢਾਈ ਅਲੱਗ ਅਲੱਗ ਤਰ੍ਹਾਂ ਦੀਆਂ ਕਢਾਈਆਂ ਸੂਟਾਂ ਉੱਪਰ ਚਾਦਰਾਂ ਸ਼ੀਟਾਂ ਇਹਨਾਂ ਨੂੰ ਲੈ ਕੇ ਅੱਜ ਕੱਲ੍ਹ ਇਹਨਾਂ ਦਾ ਕੰਮ ਫਿਰ ਦੁਬਾਰਾ ਚਲਨ ਵਿੱਚ ਆ ਰਿਹਾ ਹੈ ਜਿਹਨਾਂ ਨੂੰ ਲੈ ਕੇ ਅਸੀਂ ਇਹਨੂੰ ਇੰਡੀਆ ਨੂੰ ਪ੍ਰਟੈਂਡ ਕਰ ਸਕਦੇ ਹਾਂ ਥੈਂਕ ਯੂ